ਪੰਜਾਬੀ ਭਾਸ਼ਾ ਅਸੀਂ ਆਪਣੇ ਮਾਂ ਬਾਪ ਦਾਦਾ ਦਾਦੀ ਘਰ ਵਿੱਚ ਹੀ ਜੰਮਣ ਸੁਣ ਤੋਂ ਜੰਮਣ ਤੋਂ ਬਾਅਦ ਸਿੱਖੀ ਇਹਦੇ ਵਾਸਤੇ ਸਿੱਖਣੀ ਬਹੁਤ ਸੌਖੀ ਹੈ ਕਿਉਂਕਿ ਸਾਡੀ ਜਾਮਣੂ ਭਾਸ਼ਾ ਪੰਜਾਬੀ ਹੈ ਸਾਨੂੰ ਇਹ ਬਹੁਤ ਪਿਆਰ ਨਾਲ ਉਸ ਉਹ ਹੈ ਵ ਪਿਆਰੀ ਹੈ ਅਤੇ ਸਕੂਲ ਵਿੱਚ ਵੀ ਜਿਹੜਾ ਸਾਡਾ ਮੀਡੀਅਮ ਉਹ ਪੰਜਾਬੀ ਸੀ ਪੰਜਾਬੀ ਭਾਸ਼ਾ ਦੇ ਵਿੱਚ ਪਹਿਲਾਂ ਦੋ ਅੱਖਰ ਫਿਰ ਤਿੰਨ ਅੱਖਰ ਚਾਰ ਅੱਖਰ ਆਉਂਦੇ ਹਨ ਚਾਰ ਅੱਖਰ ਤੋਂ ਬਾਅਦ ਫਿਰ ਪਹਿਰਾ ਕ ਸ਼ੁਰੂ ਹੋ ਜਾਂਦਾ ਹੈ ਪਹਿਰੇ ਤੋਂ ਬਾਅਦ ਫਿਰ ਲੇਖ ਵਗੈਰਾ ਲਿਖ ਹੋ ਜਾਂਦੇ ਹਨ ਕਹਾਣੀਆਂ ਹੋਰ ਬਹੁਤ ਕਿੱਸੇ ਬਹੁਤ ਪੰਜਾਬੀ ਦੇ ਮਸ਼ਹੂਰ ਹਨ ਪੰਜਾਬੀ ਹੋਣ 'ਤੇ ਸਾਨੂੰ ਬਹੁਤ ਮਾਣ ਹੈ